ਮੋਹਾਲੀ ਜ਼ਿਲ੍ਹੇ ਵਿੱਚ ਸਥਾਨਕ ਸਰਕਾਰਾਂ ਅਤੇ ਰਾਜਨੀਤਿਕ ਢਾਂਚੇ ਕਾਫੀ ਹੱਦ ਤੱਕ ਬਹੁਤ ਚੰਗੇ ਹਨ ਜਿਸ ਕਰਕੇ ਮੋਹਾਲੀ ਜ਼ਿਲ੍ਹਾ ਅੱਜ ਬਹੁਤ ਚੰਗੇ ਜ਼ਿਲ੍ਹੇ ਵਿੱਚ ਵਿਕਸਿਤ ਹੋ ਗਿਆ ਹੈ ਜਿਸ ਕਰਕੇ ਮੋਹਾਲੀ ਜ਼ਿਲ੍ਹਾ ਬਹੁਤ ਹੀ ਵਿਕਸਿਤ ਬਣ ਗਿਆ ਹੈ ਮੋਹਾਲੀ ਵਿੱਚ ਰੁਜ਼ਗਾਰਾਂ ਦੇ ਬਹੁਤ ਸਾਰੇ ਸਾਧਨ ਵਿਕਸਿਤ ਹੋਏ ਹਨ ਜਿਸ ਕਰਕੇ ਕਮਾਈ ਦੇ ਸਾਧਨ ਵੀ ਵੱਧ ਚੁੱਕੇ ਹਨ ਜਿਸ ਕਰਕੇ ਆਵਾਜਾਈ ਦਾ ਸਾਧਨ ਆਵਾਜਾਈ ਦੇ ਸਾਧਨਾਂ ਵਿੱਚ ਵੀ ਬਹੁਤ ਵਿਕਾਸ ਹੋਇਆ ਹੈ ਅਮ ਮੋਹਾਲੀ ਜ਼ਿਲ੍ਹਾ ਬਹੁਤ ਹੀ ਵਿਕਸਿਤ ਹੋ ਚੁੱਕਿਆ ਹੈ ਬਾਕੀ ਸਰਕਾਰਾਂ ਬਾਰੇ ਮੈਨੂੰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ ਇਸ ਲਈ ਮੈਂ ਕਹਿਣਾ ਚਾਹਵਾਂਗੀ ਮੈਨੂੰ ਜ਼ਿਲ੍ਹੇ ਦੇ ਵਿਧਾਇਕਾਂ ਦੇ ਨਾਮ ਯਾਦ ਨਹੀਂ ਹਨ